ਸਾਡੇ ਘਰ ਇੱਕ ਨਵੀਂ ਟੋਕਨੋਲਜੀ ਦਾ ਇੱਕ ਪੀ ਸੀ ਆ ਜੋ ਕਿ ਸਾਨੂੰ ਬਹੁਤ ਸਾਰੇ ਇਨਫੋਰਮੇਸ਼ਨ ਦਿੰਦਾ ਹੈ ਔਰ ਸਾਡੇ ਘਰ ਟੈਕਨੋਲਜੀ ਦੇ ਰਿਕਾਰਡਿੰਗ ਇੱਕ ਮੋਬਾਈਲ ਫੋਨ ਹੈ ਜਿਹਨੂੰ ਆਪਾਂ ਹਾ ਆਮ ਲਾਈਫ ਦੇ ਵਿੱਚ ਯੂਜ ਕਰਦੇ ਹਾਂ ਟੈਕਨੋਲਜੀ ਦਾ ਯੁੱਗ ਹੈ ਸੋ ਆਪਾਂ ਨੂੰ ਹਰ ਇੱਕ ਪਰਸਨ ਨੂੰ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਨੂੰ ਟੈਕਨੋਲਜੀ ਦੇ ਅਪਡੇਟ ਹਰ ਇੱਕ ਚੀਜ਼ ਦੀ ਨੌਲੇਜ ਹੋਵੇ ਔਰ ਮੈਨੂੰ ਬਹੁਤ ਹੀ ਸਹਾਈ ਹੁੰਦਾ ਹੈ ਜਦੋਂ ਮੈਂ ਆਪਣੇ ਕੰਪਿਊਟਰ ਦੇ ਉੱਪਰ ਬੈਠ ਕੇ ਆਪਣੀ ਅਪਡੇਟ ਸਾਰੇ ਆਪਣੇ ਵਰਡ ਦੀ ਇਨਫੋਰਮੇਸ਼ਨ ਲੈਂਦੀ ਹਾਂ ਸੋ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਉਸ 'ਤੇ ਕੰਮ ਕਰਨਾ ਤਾਂ ਉਹ ਜਿਹੜਾ ਯੰਤਰ ਆ ਉਹ ਜੋ ਬਹੁਤ ਹੀ ਵਧੀਆ ਯੰਤਰ ਹੈ ਸੋ ਸਭ ਦੇ ਘਰ ਹੀ ਉਹ ਯੰਤਰ ਹੋਣਾ ਚਾਹੀਦਾ ਹੈ ਇਲੈਕਟਰੇਨੀਕਲ ਯੰਤਰ ਐਂਡ ਟੈਕਨੋਲਜੀ 'ਤੇ ਉਹ ਚੱਲਦਾ ਹੈ ਟੈਕਨੋਲਜੀ ਬਹੁਤ ਜ਼ਿਆਦਾ ਪ੍ਰੋਵਾਈਡ ਹੁੰਦੀ ਹੈ ਔਰ ਸਾਡੀ ਜੋ ਨੌਲੇਜ ਆ ਉਹਦੇ ਵਿੱਚ ਬਹੁਤ ਜ਼ਿਆਦਾ ਤਬਦੀਲ ਆਉਂਦੀ ਹੈ ਇਸ ਤਰ੍ਹਾਂ ਹੀ ਸਾਨੂੰ ਆਪਣੇ ਹਰ ਇੱਕ ਯੰਤਰ ਜਿਵੇਂ ਕਿ ਕੰਪਿਊਟਰ ਪੀ ਸੀ ਲੈਪਟੋਪ ਮੋਬਾਈਲ ਫੋਨ ਹੋਰ ਚੀਜ਼ਾਂ ਆਪਣੇ ਨਾਲ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਆਪਾਂ ਨੂੰ ਆਲੇ ਦੁਆਲੇ 'ਚ ਵੀ ਹੁੰਦਾ ਹੈ ਆਪਾਂ ਨੂੰ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਰਹੇ ਹਰ ਇੱਕ ਵਿਅਕਤੀ ਲਈ ਬਹੁਤ ਹੀ ਮਹੱਤਵਪੂਰਨ ਰੱਖਦੀ ਹੈ ਇਹ ਚੀਜ਼